ਸਲਾਈ ਮਸ਼ੀਨ ਸਿਲਾਈ ਲਈ ਵਰਤੀਆਂ ਜਾਣ ਵਾਲੇ ਟੂਰਜ ਸਲਾਈ ਮਸ਼ੀਨ ਥਰੈਡ ਕੈਂਚੀ ਚੌਕ ਸਭ ਇਹ ਚੀਜ਼ਾਂ ਮੇਰੇ ਕੋਲ ਹਨ ਪਰ ਇਸ ਤੋਂ ਬੈਟਰ ਮੈਂ ਇਹਨੂੰ ਇਹ ਕਢਾਈ ਦਾ ਬਹੁਤ ਸ਼ੌਂਕ ਹ ਮੇਰੇ ਮਨ ਵਿੱਚ ਰੀਝ ਹੁੰਦੀ ਹੈ ਕਿ ਮੈਂ ਇੱਕ ਜੋ ਅੱਜ ਕੱਲ ਨਵੀਂ ਤਕਨੀਕ ਨਾਲ ਕਢਾਈ ਵਾਲੀਆਂ ਮਸ਼ੀਨਾਂ ਚੱਲ ਰਹੀਆਂ ਹਨ ਮੇਰੇ ਮਨ ਵਿੱਚ ਇਹ ਰੀਝ ਹੈ ਕੀ ਮੈਂ ਵੀ ਉਹ ਮਸ਼ੀਨ ਲੈ ਕੇ ਆਵਾਂ ਜਿਸ ਨਾਲ ਮੈਂ ਘਰੇ ਬੈਠ ਕੇ ਆਪਣਾ ਕਢਾਈ ਦਾ ਬਿਜਨਸ ਵੀ ਸਟਾਰਟ ਕਰ ਲਵਾਂ ਜੋ ਕਿ ਮੇਰਾ ਕਿਤੇ ਮੈਨੂੰ ਜਾਣ ਦੀ ਜਰੂਰਤ ਨਾ ਪਵੇ ਇਹ ਕੰਮ ਮੇਰਾ ਹੋਰ ਵੀ ਅੱਗੇ ਵੱਧ ਜਾਵੇ ਜਿਸ ਨਾਲ ਮੈਂ ਬਹੁਤ ਜਿਆਦਾ ਅੱਗੇ ਨਾਲੋਂ ਵੀ ਹੋਰ ਵੀ ਤਰੱਕੀ ਕਰਾਂ ਇਕ ਮੇਰਾ ਮੇਰੇ ਮਾਇੰਡ ਵਿੱਚ ਆਉਂਦਾ ਹੈ ਕਿ ਮੈਂ ਪੀਕੋ ਵਾਲੀ ਮਸ਼ੀਨ ਵੀ ਘਰ ਲੈ ਕੇ ਆਵਾਂ ਜਾ ਸੋਹਣੇ ਚ ਮੈਨੂੰ ਬਾਹਰ ਜਾ ਕੇ ਕੱਪੜਿਆਂ ਦੀ ਪੀਕੋ ਕਰਾਉਣ ਵਿੱਚ ਟਾਈਮ ਵੇਸਟ ਨਾ ਹੋਵੇ ਜੇ ਮੈਂ ਆਪਣੇ ਘਰ ਹੀ ਪੀਕੋ ਦਾ ਕੰਮ ਵੀ ਕਰ ਸਕਾਂ ਔਰ ਹੋਰ ਲੋਕਾਂ ਦਾ ਵੀ ਇਹ ਕੰਮ ਮੈਂ ਆਪਣੇ ਘਰ ਬੈਠ ਕੇ ਕਰਕੇ ਮੈਂ ਹੋਰ ਵੀ ਇਨਕਮ ਕਮਾ ਸਕਾ ਕੜਾਈ ਵਾਲੀ ਮਸ਼ੀਨ ਨਾਲ ਮੈਂ ਆਪਣੇ ਆਪਣੇ ਹੋਰ ਕਸਟਮਰਾਂ ਦੇ ਸੂਟ ਵਧੀਆ ਕਢਾਈ ਕਰਕੇ ਦੇ ਸਕਾ ਜਿਸ ਨਾਲ ਮੇਰਾ ਬਿਜਨਸ ਹੋਰ ਵੀ ਅੱਗੇ ਤਰੱਕੀ ਤਰੱਕੀ ਕਰੇ ਮੈਨੂੰ ਅੱਗੇ ਕੰਮ ਕਰਨ ਵਿੱਚ ਬਹੁਤ ਹੀ ਜਿਆਦਾ ਵਧੀਆ ਲੱਗਦਾ ਹੈ ਮੈਨੂੰ ਸਿਲਾਈ ਦਾ ਕੰਮ ਅੱਗੇ ਵਧਾਉਣ ਵਿੱਚ ਬਹੁਤ ਜਿਆਦਾ ਦਿਲਚਸਪੀ ਹੈ ਮੇਰਾ ਕੰਮ ਅੱਗੇ ਹੋਰ ਜਿਆਦਾ ਅੱਗੇ ਵਧੇ ਮੈਂ ਹੋਰ ਵੀ ਇੱਕ ਦੋ ਮਸ਼ੀਨਾਂ ਖਰੀਦ ਸਕਾਂ ਇਹਨਾਂ ਨੂੰ ਮੈਂ ਖਰੀਦਣਾ ਚਾਹੁੰਦੀ ਹਾਂ